ਅਧਿਆਪਕ ਤੋਂ ਬਿਨਾਂ ਅਸੀਂ ਕੋਈ ਵੀ ਮਤਲਬ ਸਿੱਖਿਆ ਲੈਣੀ ਆ ਕੋ ਗਾਇਕੀ ਸਿੱਖਣੀ ਆ ਚਾਹੇ ਕੁਛ ਵੀ ਆ ਹੋਰ ਕੰਮ ਆ ਪੜ੍ਹਾਈ ਲੈ ਲਓ ਹੱਥੀਂ ਕੰਮ ਲ ਦਾ ਕੋਈ ਵੀ ਤਜਰਬਾ ਲੈ ਲਓ ਜੇ ਜਿੰਨੀ ਦੇਰ ਤੱਕ ਸਾਡੇ ਕੋਲ ਕੋਈ ਗੁਰੂ ਨਹੀਂ ਹੋਊਗਾ ਅਸ ਅਸੀਂ ਪੂਰੀ ਤਰ੍ਹਾਂ ਉਹਦੀਆਂ ਨਾ ਕੰਮ ਦੀਆਂ ਬਰੀਕੀਆਂ ਸਮਝ ਸਕਦੇ ਹਾਂ ਨਾ ਸਾਡੇ ਜੋ ਕੰਮ ਦਾ ਨਿਖਾਰ ਆਊਗਾ ਹੁਣ ਗਾਇਕੀ ਦੇ ਲਈ ਵੀ ਗੁਰੂ ਦਾ ਹੋਣਾ ਬਹੁਤ ਜ਼ਰੂਰੀ ਆ ਕਿਉਂਕਿ ਗੁਰੂ ਹੀ ਆ ਕਿ ਜਿਹੜਾ ਤੁਹਾਨੂੰ ਉਹ ਪੂਰੀ ਤਰ੍ਹਾ ਰਿਆਜ਼ ਕਰਵਾਉਂਦਾ ਹੈ ਗਾਇਕੀ ਵਿੱਚ ਕਿੰਨੇ ਸੁਰ ਤਾਲ ਆ ਲੈਅ ਆ ਉਹ ਗੁਰੂ ਤੋਂ ਬਿਨਾਂ ਹੀ ਤਾਂ ਉਹਨਾਂ ਚੀਜ਼ਾਂ ਨੂੰ ਸਮਝ ਹੀ ਨਹੀਂ ਸਕਦੇ ਸਾਨੂੰ ਉਹ ਸਾਰਾ ਕੁਛ ਇੱਕੋ ਜਿਹਾ ਹੀ ਲੱਗੀ ਜਾਂਦਾ ਸਾਨੂੰ ਨਹੀਂ ਪਤਾ ਕਿ ਉਹ ਸੁਰ ਕਿੱਥੋਂ ਉੱਪਰ ਦਾ ਲੈਣਾ ਹੈ ਕਿੱਥੋਂ ਨੀਚੇ ਦਾ ਲੈਣਾ ਉਹ ਪੂਰੀ ਤਰ੍ਹਾਂ ਸਾਨੂੰ ਉਹਦੀਆਂ ਬਰੀਕੀਆਂ ਸਿਖਾਉਂਦੇ ਆ ਅਤੇ ਮੇਰੇ ਜਿਹੜੇ ਗੁਰੂ ਆ ਉਹ ਬਹੁਤ ਮਤਲਬ ਮੈਨੂੰ ਲੱਗਦਾ ਕਿ ਪਹੁੰਚੇ ਹੋਏ ਆ ਕਿ ਉਹਨਾਂ ਕੋਲ ਇੰਨਾ ਜ਼ਿਆਦਾ ਰਿਆਜ਼ ਉਹਨਾਂ ਨੇ ਕੀਤਾ ਹੋਇਆ ਕਿ ਉਹ ਥੋੜ੍ਹਾ ਜਿਹਾ ਵੀ ਸਿਖਾਉਂਦੇ ਆ ਤਾਂ ਉਸ ਤੋਂ ਵੱਧ ਸਿੱਖਣ ਨੂੰ ਜੀਅ ਕਰਦਾ ਕਿ ਉਹਨਾਂ ਨੂੰ ਹਰ ਚੀਜ਼ ਦੀ ਇੰਨੀ ਨੌਲੇਜ ਆ ਉਹ ਹਰ ਸੁਰ ਨੂੰ ਹਰ ਲੈਅ ਨੂੰ ਬੜੇ ਵਧੀਆ ਤਰੀਕੇ ਨਾਲ ਮੈਨੂੰ ਸਿਖਾ ਰਹੇ ਆ ਅਤੇ ਮੈਨੂੰ ਕਦੀ ਵੀ ਨਹੀਂ ਉਹਨਾਂ ਨੇ ਮਹਿਸੂਸ ਹੋਣ ਦਿੱਤਾ ਕਿ ਹਾਂ ਬਈ ਮੈਂ ਤੈਨੂੰ ਇੰਨਾ ਜ਼ਿਆਦਾ ਕਿਉਂ ਉੱਪਰ ਤੱਕ ਸਿਖਾਵਾਂ ਜਾਂ ਸਮਝਾਵਾਂ ਨਾ ਉਹਨਾਂ ਨੇ ਮਨ 'ਚ ਕਦੀ ਖੋਟ ਲਿਆ ਕੇ ਨਹੀਂ ਸਿਖਾਇਆ ਕਦੀ ਵੀ ਉਹਨਾਂ ਦੇ ਮਨ 'ਚ ਇਹ ਨਹੀਂ ਆਇਆ ਕਿ ਇਹ ਮੇਰੇ ਤੋਂ ਵੱਧ ਨਾ ਕਿਤੇ ਸਿੱਖ ਕੇ ਚਲੀ ਜਾਵੇ ਉਹਨਾਂ ਨੇ ਹਰ ਵਕਤ ਮਤਲਬ ਵੱਧ ਤੋਂ ਵੱਧ ਸਿਖਾਉਣ ਦੀ ਕੋਸ਼ਿਸ਼ ਕੀਤੀ ਆ ਅਤੇ ਮੈਂ ਵੀ ਜਦੋਂ ਦੀ ਉਹਨਾਂ ਕੋਲ ਗਈ ਹਾਂ ਇੰਨਾ ਜ਼ਿਆਦਾ ਮੈਂ ਸਿੱਖ ਲਿਆ ਕਿ ਜਦੋਂ ਹੁਣ ਮੈਂ ਕਿਤੇ ਗਾਇਕੀ ਕਰਦੀ ਹਾਂ ਮੈਨੂੰ ਗਾਉਣ ਦਾ ਮੌਕਾ ਮਿਲਦਾ ਤਾਂ ਹਰ ਕੋਈ ਇੱਕ ਵਾਰੀ ਜ਼ਰੂਰ ਪੁੱਛਦਾ ਕਿ ਹਾਂ ਕਿਸ ਗੁਰੂ ਕੋਲ ਸਿੱਖ ਰਹੀ ਹਾਂ ਤਾਂ ਮੈਨੂੰ ਬੜੀ ਖੁਸ਼ੀ ਜਿਹੀ ਮਹਿਸੂਸ ਹੁੰਦੀ ਆ ਮੈਂ ਆਪਣੇ ਗੁਰੂ ਤੋਂ ਬਸ ਇੱਕੋ ਚੀਜ਼ ਜਿਹੜੀ ਸਿੱਖੀ ਆ ਉਹ ਇੱਕ ਤਾਂ ਇਹ ਆ ਕਿ ਵੀ ਕੱਲ੍ਹ ਨੂੰ ਅਗਰ ਮੇਰੇ ਕੋਲ ਕੋਈ ਆਊਗਾ ਮੇ ਮੈਂ ਕਿਸੇ ਬੱਚੇ ਨੂੰ ਸਿਖਾਵਾਂ ਕਿਸੇ ਨੂੰ ਵੀ ਗਾਇਕੀ ਸਿਖਾਵਾਂ ਤਾਂ ਮੈਂ ਵੀ ਪੂਰੇ ਦਿਲ ਜਾਨ ਨਾਲ ਸਿਖਾਵਾਂ ਮੈਂ ਵੀ ਕਦੀ ਮਨ 'ਚ ਖੋਟ ਰੱਖ ਕੇ ਨਹੀਂ ਸਿਖਾਵਾਂ ਕਿ ਹਾਂ ਮੈਂ ਇਹਨੂੰ ਇੰਨਾ ਗਿਆਨ ਨਹੀਂ ਦਊਂਗੀ ਇੰਨੀਆਂ ਬਰੀਕੀਆਂ ਨਹੀਂ ਦਊਂਗੀ ਉਹਨਾਂ ਨੇ ਤਾਂ ਮੈਨੂੰ ਮਤਲਬ ਪੂਰਾ ਸਿਖਾ ਤਾ ਕਿ ਹਾਂ ਗੁਰੂ ਬਿਨਾਂ ਤਾਂ ਜਿਵੇਂ ਗਤ ਨਹੀਂ ਮੇਰੇ ਗੁਰੂ ਤਾਂ ਮੇਰੇ 'ਚ ਇੰਨੀ ਜ਼ਿਆਦਾ ਉਹ ਇੱਕ ਵੱਖਰੀ ਊਰਜਾ ਲੈ ਕੇ ਆ ਰਹੇ ਆ ਕਿ ਮੈਨੂੰ ਕਈ ਵਾਰੀ ਆਪਣੇ ਆਪ 'ਤੇ ਯਕੀਨ ਨਹੀਂ ਹੁੰਦਾ ਕਿ ਮੈਂ ਇੰਨਾ ਵਧੀਆ ਸਿੱਖ ਕੇ ਕਰ ਰਹੀ ਹਾਂ ਤਾਂ ਚੰਗੇ ਗੁਰੂ ਦਾ ਹੋਣਾ ਸਾਡੇ ਲਈ ਬਹੁਤ ਜ਼ਰੂਰੀ ਆ